ਮੇਰੀ ਰਾਇ ਅਨੁਸਾਰ ਹਰੇਕ ਪਿੰਡ ਦੇ ਵਿੱਚ ਯਾਤਰਾ ਦੇ ਲਈ ਘੱਟੋ ਘੱਟ ਇੱਕ ਜਾਂ ਦੋ ਬੱਸਾਂ ਦਾ ਇੰਤਜ਼ਾਮ ਕੀਤਾ ਹੋਣਾ ਚਾਹੀਦਾ ਹੈ ਜਦੋਂ ਵੀ ਕਿਤੇ ਆਪਾਂ ਨੇ ਕਿਸੇ ਸ਼ਹਿ ਯਾਤਰਾ 'ਤੇ ਜਾਣਾ ਹੈ ਤਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਰਾਏ ਕਰਕੇ ਅਤੇ ਆਪਣੇ ਕਿਸੇ ਗੁਰਦੁਆਰੇ ਦੀ ਯਾਤਰਾ 'ਤੇ ਜਾਣਾ ਕਿਤੇ ਵੀ ਜਾਣਾ ਤਾਂ ਜਾ ਸਕਦੇ ਨੇ ਅਤੇ ਸੈਰ ਸਪਾਟੇ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਵਿੱਚ ਸੈਰ ਸਪਾਟੇ ਲਈ ਇੱਕ ਤਾਂ ਪਾਰਕ ਬਹੁਤ ਜ਼ਰੂਰੀ ਆ ਅਤੇ ਪਾਰਕ ਦੇ ਅੰਦਰ ਰਾਤ ਨੂੰ ਲਾਈਟਾਂ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ ਹੈ ਜੋ ਕਿ ਰਾਤ ਨੂੰ ਜਿਸ ਨੇ ਵੀ ਘੁੰਮਣਾ ਤਾਂ ਉੱਥੇ ਲਾਈਟ ਦਾ ਪ੍ਰਬੰਧ ਹੋਵੇ ਸਾਰਾ ਕੁਛ ਦਿਖਦਾ ਹੋਵੇ ਬੰਦਾ ਆਸਾਨੀ ਨਾਲ ਘੁੰਮ ਸਕਦਾ ਹੈ ਅਤੇ ਪਿੰਡ ਦੇ ਵਿੱਚ ਪਿੰਡ ਦੇ ਆਲੇ ਦੁਆਲੇ ਸਾਰੇ ਸਫਾਈ ਹੋਣੀ ਚਾਹੀਦੀ ਹੈ ਜਿਸ ਨੇ ਕਈ ਸੜਕਾਂ ਦੀ ਵੀ ਸਫਾਈ ਹੋਣੀ ਚਾਹੀਦੀ ਹੈ ਜਿਸ ਨੇ ਕਿ ਸੜਕ ਦੇ ਉੱਤੇ ਘੁੰਮਣਾ ਸੜਕ 'ਤੇ ਜਾਣਾ ਸੈਰ ਕਰਨ ਅਤੇ ਉੱਥੇ ਵੀ ਸੜਕ ਦੇ ਆਲੇ ਦੁਆਲੇ ਲਾਈਟਾਂ ਦਾ ਖਾਸ ਪ੍ਰਬੰਧ ਹੋਣਾ ਚਾਹੀਦਾ ਹੈ